ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਐ ਹਾਂਜੀ ਹਾਂਜੀ ਉਹ ਮੈਂ ਕਾਫੀ ਦੇਰ ਬਾਅਦ ਈ ਆਇਆਂ ਹੁਸ਼ਿਆਰਪੁਰ ਕਾਫੀ ਦੇਰ ਬਾਦ ਗੇੜਾ ਲੱਗਾ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ ਤਾਹੀਂ ਆਇਆਂ ਮੈਂ ਕਿਹਾ ਯਾਰ ਘੁੰਮ ਕੇ ਆਈਏ ਫੇਰ ਮੈਂ ਆਇਆ ਸੀ ਟਰੇਨ ਤਾਂ ਮੇਰੀ ਕੈਂਸਲ ਹੋਗੀ ਟਿਕਟ ਤਾਂ ਅੱਜ ਵਾਪਸੀ ਸੀ ਵੈਸੇ ਤਾਂ ਹਾਂਜੀ ਕੋਈ ਪ੍ਰੋਬਲਮ ਕਰਕੇ ਤਾਂ ਹੁਣ ਦੋ ਤਿੰਨ ਦਿਨ ਬਾਅਦ ਈ ਮੈਂ ਜਾਊਂਗਾ ਮੈਂ ਸੋਚਦਾਂ ਐਥੇ ਘੁੰਮ ਕੇ ਆਈਏ ਕਿਤੇ ਯਾਰ ਮੈਂ ਤੁਹਾਨੂੰ ਤਾਂ ਫੋਨ ਕੀਤਾ ਮੈਂ ਕਿਹਾ ਫੇਰ ਹੁਸ਼ਿਆਰਪੁਰ ਆਲਿਆਂ ਨੂੰ ਪੁੱਛਦੇ ਆ ਜਰਾ ਦੱਸੋ ਕੋਈ ਵਧੀਆ ਪਲੇਸ ਕਿੱਥੇ ਘੁੰਮ ਕੇ ਆਈਏ ਹਾਂਜੀ ਹਾਂਜੀ ਹਾਂਜੀ ਭਰਾ ਵੀ ਆ ਉਨ੍ਹਾਂ ਦਾ ਬੇਟਾ ਵੀ ਨਾਲ ਭਤੀਜਾ ਮੇਰਾ ਹਾਂਜੀ ਹਾਂਜੀ ਤਾਂ ਹੀ ਕੋਈ ਵਧੀਆ ਮੈਂ ਕਿਹਾ ਪੁੱਛੀਏ ਕਿਹੜੀ ਜਗ੍ਹਾ ਹੈਗੀ ਐਥੇ

ਜਗ੍ਹਾ ਨਈਂ ਨਈਂ ਮੈਂ ਤਾਂ ਗ੍ਰੀਨ ਵਿਊ ਪਸੰਦ ਕਰਦਾ ਹਰਿਆਲੀ ਹੋਵੇ ਵਧੀਆ ਤਾਂ ਕਰਕੇ ਖਾਣ ਪੀਣ ਦੀਆਂ ਚੀਜਾਂ ਤਾਂ ਦਿੱਲੀ ਬਹੁਤ ਮਿਲ ਜਾਂਦੀਆਂ ਓਥੇ ਦੀ ਗਰਮੀ ਖਾ ਖਾ ਕੇ ਹੁਣ ਥੱਕ ਗਏ ਹਾਂ

ਕਾਰ ਚ ਹੀ ਜਾਵਾਂਗੇ ਮੈਂ ਤਾਂ ਬਾਈਕਿੰਗ ਪਸੰਦ ਕਰਦਾਂ ਵੈਸੇ ਪਰ ਹੁਣ ਬਾਈਕ ਤਾਂ ਨੀ ਹੈਗੀ ਹੂੰ ਹਾਂਜੀ ਅੱਛਾ ਜੀ ਇਹ ਕਿੰਨੀ ਕ ਦੂਰ ਪੈ ਜਾਂਦਾ ਇਹ

ਅੱਛਾ ਜੀ ਮੈਨੇ ਤਾਂ ਕਦੇ ਸੋਚਿਆ ਨੀ ਸੀ ਐਥੇ ਜੰਗਲ ਸਫਾਰੀ ਵੀ ਹੋ ਸਕਦੀ ਐ ਹੁਸ਼ਿਆਰਪੁਰ ਚ ਠੀਕ ਐ ਰਿਸੈਂਟ ਬਣੀ ਹੋਣੀ ਹੁਣ ਪਹਿਲਾਂ ਮੈਂ ਆਇਆ ਸੀ ਓਦੋਂ ਤਾਂ ਨੀ ਸੀਗਾ ਮੈਨੂੰ ਲੱਗਦਾ ਤਾਹੀਂ ਅੱਛਾ ਫੇਰ ਉਹਦੇ ਫੀਸ ਫੂਸ ਪਤਾ ਕੁਛ ਕੀ ਚਾਰਜਸ ਲੈਂਦੇ ਕੁਛ ਫੇਰ ਤਾਂ ਠੀਕ ਐ ਜੈਨੂਅਨ ਐ ਅੱਛਾ ਜੀ ਫੇਰ ਸਟੇ ਵੀ ਕਰ ਸਕਦੇ ਉੱਥੇ ਅੱਛਾ ਜੀ ਠੀਕ ਐ ਤੇ ਕੋਈ ਹੋਰ ਉਹਤੋਂ ਇਲਾਵਾ ਕੋਈ ਜਗ੍ਹਾ ਹੋਵੇ ਜੇ ਅੱਗੇ ਹੋਰ ਕਿਤੇ ਜਾਣਾ ਅੱਛਾ ਜੀ ਚਲੋ ਵਧੀਆ ਠੀਕ ਐ ਓਥੇ ਤੇ ਖਾਣਾ ਵਗੈਰਾ ਵਧੀਆ ਮਿਲਜੂ ਹੈਨਾ ਓਥੇ ਅੱਛਾ ਜੀ ਕਿੰਨੀ ਕ ਦੂਰ ਪੈ ਜਾਣਾ ਓਥੋਂ ਲਾਗੇ ਲਾਗੇ ਨੇ ਠੀਕ ਐ ਹਾਂ ਮੈਂ ਜਰੂਰ ਦੱਸੁੰਗਾ ਤੁਸੀਂ ਵੀ ਚੱਲ ਸਕਦੇ ਜੇ ਜਾਣਾ ਨਾਲ ਤਾਂ ਅੱਛਾ ਜੀ ਠੀਕ ਐ ਮੈਂ ਕੋਈ ਨਾ ਦੱਸੁੰਗਾ ਜਰੂਰ ਥੋਨੂੰ ਕਿੱਦਾਂ ਦਾ ਰਿਆ ਓਕੇ ਬਾਏ ਥੈਂਕਿਊ ਥੈਂਕਿਊ